ਅਸੀਂ ਤਾਰੇ ਅਤੇ ਬ੍ਰਹਿਮੰਡਾਂ ਦੇ ਅਧਿਐਨ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਕਿਉਂਕਿ ਆਕਾਸ਼ ਵਿੱਚ ਅਣਗਿਣਤ ਤਾਰੇ ਹਨ ਜਿਨ੍ਹਾਂ ਨੂੰ ਨਾ ਤਾਂ ਅਸੀਂ ਕਦੇ ਗਿਣਿਆ ਜਾ ਸਕਦਾ ਹੈ ਸਾਰੇ ਤਾਰੇ ਸੂਰਜ ਦੇ ਅੱਗ ਦੇ ਗੋਲੇ ਹਨ ਅਤੇ ਸੂਰਜ ਤੋਂ ਕਈ ਗੁਣਾ ਵੱਡੇ ਹਨ ਪਰ ਤਾਰਿਆਂ ਵਿੱਚ ਜੀਵਨ ਨਹੀਂ ਹੈ ਕਿਉਂਕਿ ਉੱਥੇ ਧਰਤੀ ਨਹੀਂ ਹੈ ਜਿੱਥੇ ਕਿ ਜੀਵਨ ਬਤੀਤ ਕਰ ਸਕੀਏ ਬਾਣੀ ਵਿੱਚ ਵੀ ਲਿਖਿਆ ਹੈ ਪਾਤਾਲਾ ਪਾਤਾਲ ਲੱਖ ਅਗਾਸਾ ਆਗਾਸ ਚੀਨ ਨੇ ਤਾਰੇ ਅਤੇ ਬ੍ਰਹਿਮੰਡ ਦਾ ਅਧਿਐਨ ਕੀਤਾ ਹੈ ਪਰ ਫਿਰ ਵੀ ਉਸ ਨਾਲ ਛੇੜ ਛਾੜ ਕੀਤੀ ਪਰ ਇਸ ਨਾਲ ਉਸ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ ਜਿਸ ਨਾਲ ਜੀਵਨ ਵਿੱਚ ਲਾਵਾ ਫੁੱਟਿਆ ਅਤੇ ਲਾਵਾ ਫੁੱਟਣ ਨਾਲ ਕਈ ਬਿਮਾਰੀਆਂ ਫੈਲੀਆਂ ਜਿਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਲੋਕ ਹੋਏ ਹਨ ਅਤੇ ਬਿਮਾਰੀ ਦੇ ਸ਼ਿਕਾਰ ਹੋਣ ਨਾਲ ਕਈ ਲੋਕਾਂ ਦੀ ਜਾਨ ਵੀ ਚਲੇੇ ਗਈ ਹੈ ਸਾਨੂੰ ਚਾਹੀਦਾ ਹੈ ਕਿ ਜੇਕਰ ਸਾਨੂੰ ਇਸ ਬਾਰੇ ਪੂਰਾ ਗਿਆਨ ਨਹੀਂ ਹੈ ਤਾਂ ਸਾਨੂੰ ਤਾਰੇ ਅਤੇ ਬ੍ਰਹਿਮੰਡ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਹੈ